ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਕਾਫੀ ਤਰ੍ਹਾਂ ਦੇ ਸੱਭਿਆਚਾਰਕ ਅੰਤਰ ਦੇਖੇ ਜਾਂਦੇ ਹਨ ਜਿਵੇਂ ਕਿ ਭਾਸ਼ਾ ਉੱਤਰੀ ਭਾਰਤ ਵਿੱਚ ਲੋਕ ਪੰਜਾਬੀ ਗੁਜਰਾਤੀ ਬਿਹਾਰੀ ਅਤੇ ਅਤੇ ਦੱਖਣੀ ਭਾਰਤ ਵਿੱਚ ਲੋਕ ਕੰਨੜ ਮਲਿਆਲਮ ਆਦਿ ਭਾਸ਼ਾ ਬੋਲਦੇ ਹਨ ਅਤੇ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਭੋਜਨ ਦਾ ਵੀ ਕਾ ਕਾਫੀ ਵਖਰੇਵਾਂ ਹੈ ਉੱਤਰੀ ਭਾਰਤ ਵਿੱਚ ਲੋਕ ਸਾਗ ਨਾਲ ਮੱਕੀ ਦੀ ਰੋਟੀ ਦਹੀਂ ਦਹੀਂ ਪਰ ਦੱਖਣੀ ਭਾਰਤ ਵਿੱਚ ਲੋਕ ਇਡਲੀ ਸਾਂਬਰ ਆਦਿ ਖਾਂਦੇ ਹਨ ਉੱਥੇ ਕੱਪੜਿਆਂ ਦਾ ਵੀ ਕਾਫੀ ਫਰਕ ਹੈ ਉੱਤਰੀ ਭਾਰਤ ਵਿੱਚ ਲੋਕ ਕੁੜਤਾ ਪਜਾਮਾ ਅਤੇ ਦੱਖਣੀ ਭਾਰਤ ਵਿੱਚ ਲੋਕ ਲੂੰਗੀ ਪਾਉਂਦੇ ਹਨ ਅਤੇ ਮੌਸਮ ਦਾ ਫਰਕ ਵਧੇਰੇ ਹੈ ਉੱਤਰੀ ਭਾਰਤ ਵਿੱਚ ਮੌਸਮ ਅਲੱਗ ਰਹਿੰਦਾ ਹੈ ਅਤੇ ਦੱਖਣੀ ਭਾਰਤ ਵਿੱਚ ਮੌਸਮ ਅਲੱਗ ਰਹਿੰਦਾ ਹੈ